ਮੇਰੇ ਕੋਲ ਇੱਕ ਬਹੁਤ ਹੀ ਵਧੀਆ ਸੈਮਸੰਗ ਦਾ ਫੋਨ ਹੈ ਜਿਸ ਦਾ ਕੈਮਰਾ ਬਹੁਤ ਹੀ ਜ਼ਿਆਦਾ ਵਧੀਆ ਹੈ ਫੋਟੋ ਖਿੱਚਣ ਦੇ ਨਾਲ ਨਾਲ ਮੈਂ ਇਸ ਕੈਮਰੇ ਦੀ ਵਰਤੋਂ ਕਰਦੀ ਹਾਂ ਜਿਵੇਂ ਕੀ ਰੀਲਾਂ ਬਣਾਉਣ ਲਈ ਸ਼ੋਟਸ ਬਣਾਉਣ ਲਈ ਮੈਨੂੰ ਬਹੁਤ ਹੀ ਸ਼ੌਂਕ ਹੈ ਰੀਲਾਂ ਬਣਾਉਣ ਦਾ ਅਤੇ ਮੈਂ ਆਪਣੇ ਡਾਂਸ ਦੀਆਂ ਰੀਲਾਂ ਬਣਾਉਣੀ ਹੈ ਕਦੇ ਕਦੇ ਕੋਈ ਐਕਟਿੰਗ ਵਾਲੀਆਂ ਰੀਲਾਂ ਬਣਾਉਣੀ ਹੈ ਇਸ ਲਈ ਮੈਨੂੰ ਆਪਦਾ ਫੋਨ ਬਹੁਤ ਹੀ ਵਧੀਆ ਲੱਗਦਾ ਹੈ ਐਵੇਂ ਲੱਗਦਾ ਹੈ ਕਿ ਇਹ ਫੋਟੋਆਂ ਖਿੱਚਣ ਤੋਂ ਬਹੁਤ ਹੀ ਵੱਖਰਾ ਹੈ ਇਸ ਵਿੱਚ ਬਹੁਤ ਹੀ ਸੋਹਣਾ ਵੀਡੀਓ ਸ਼ੂਟ ਹੁੰਦਾ ਹੈ ਰੀਲਾਂ ਇਸ ਵਿੱਚ ਰੀਲਾਂ ਬਹੁਤ ਹੀ ਵਧੀਆ ਐਡੀਟਿੰਗ ਐਡੀਟਿੰਗ ਵੀ ਹੁੰਦੀ ਆ ਰੀਲਾਂ ਦੀ ਬਹੁਤ ਵਧੀਆ ਮੈਂ ਇਸ ਵਿੱਚ ਬਹੁਤ ਵਧੀਆ ਰੀਲਾਂ ਦੀ ਐਡੀਟਿੰਗ ਕਰਕੇ ਰੀਲਾਂ ਨੂੰ ਅਪਲੋਡ ਕਰਦੀ ਹਾਂ